ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਵਧੀਆ ਕੀ ਕਰੀ ਜਾਂਦੀ ਹੈ ਹੋਰ ਘਰ ਠੀਕ ਹੈ ਮੰਮੀ ਠੀਕ ਹੈ ਬੱਚੇ ਠੀਕ ਹੈ ਬਸ ਮੈਂ ਵੀ ਬਸ ਘਰ ਦਾ ਹੀ ਕੰਮ ਹੈ ਮਾੜਾ ਮੋਟਾ ਕਰ ਲਈ ਦਾ ਹੋਰ ਕੀ ਕਰਨਾ ਸਲਾਈਆਂ ਬੁਣਦੀ ਤੈਨੂੰ ਪਤਾ ਤਾਂ ਹੈਗਾ ਐਟੀ ਸਲਾਈਆਂ ਹੀ ਬੁਣਦੀ ਹੈ ਹੋਰ ਤਾਂ ਕੁਛ ਕਰਦੀ ਨਹੀਂ ਹਾਂ ਬੱਚੇ ਵੀ ਠੀਕ ਹੈ ਵਧੀਆ ਬਸ ਸਭ ਗੁਰਦੁਆਰੇ ਗਏ ਬੱਚੇ ਹਾਂ ਠੀਕ ਆ ਸਾਰਾ ਕੁਛ ਹੋਰ ਸੁਣਾ ਚੱਲ ਹਾਂ ਹੋਰ ਦੱਸੋ ਮੈਂ ਕਹਿੰਦੀ ਸੀ ਵੀ ਆਪਣੇ ਜਿਹੜੇ ਆਹ ਵੇਖੀ ਘਰ ਦੇ ਵਿੱਚ ਕਿੱਡਾ ਟੋਇਆ ਪਿਆ ਹੋਇਆ ਅਤੇ ਇਹਦਾਂ ਆਪਾਂ ਕੀ ਕਰੀਏ ਹੱਲ ਹੈ ਨਾ ਆਪਾਂ ਨੂੰ ਕਰਨਾ ਪੈਣਾ ਰਲ ਮਿਲ ਕੇ

ਹਾਂ ਇਹ ਅ ਹੋਵੇ ਨਾ ਵੀ ਇੱਕ ਘਰ ਆਉਂਦਾ ਪੱਟ ਦਿੰਦਾ ਅਤੇ ਦੂਜਾ ਆਉਂਦਾ ਮਾੜਾ ਜਿਹਾ ਸਵਾਰਦਾ ਅਤੇ ਤੀਜਾ ਆ ਕੇ ਫਿਰ ਪੱਟ ਦਿੰਦਾ ਅਤੇ ਕਿੰਨਾ ਹੁਣ ਆਹ ਹੁਣ ਮੈਂ ਗੈਸ ਪਾਈਪਾਂ ਵਾਲੇ ਪਾ ਗਿਆ ਫਿਰ ਪਾਈਪਾਂ ਪਾ ਗਏ ਆ ਅਤੇ ਉਹ ਟੋਏ ਭਰੇ ਨਹੀਂ ਅਜੇ ਚੱਜ ਨਾਲ ਬੱਚੇ ਡਿੱਗ ਵੀ ਸਕਦੇ ਆ ਦੇ ਆਪਣੇ ਵਿੱਚ ਹਾਂ ਅਤੇ ਉਹ ਗੱਡੀਆਂ ਸਕੂਟਰ ਮੋਟਰਸਾਇਕਲ ਜਾਂਦੇ ਆ ਨਾ ਹਾਂ ਹੈਂ ਹਾਂ ਉਹ ਹੀ ਨਾ ਮੋਟਰਸਾਈਕਲ ਕਾਰਾਂ ਅਤੇ ਉਹਦੇ ਨਾ ਵਿੱਚ ਵਿੱਚ ਪਹੀਏ ਡਿੱਗ ਪੈਂਦੇ ਉਹਨਾਂ ਦੇ ਪਤਾ ਨਹੀਂ ਲੱਗਦਾ ਰਾਤ ਬਰਾਤੇ ਅਤੇ ਡਿੱਗ ਸਕਦੇ ਹੈ ਸਾਰੇ ਬੱਚੇ ਫਿਰ ਵੀ ਇਹ ਸੱਟ ਫੇਟ ਵੀ ਲੱਗ ਸਕਦੀ ਹੈ ਇਹਦਾ ਹੁਣ ਆਪਾਂ ਨੂੰ ਹੱਲ ਹੁਣ ਜਾਂ ਤਾਂ ਰਲ ਮਿਲ ਕੇ ਆਪ ਨੂੰ ਕਰਨਾ ਪੈਣਾ ਹੈ ਨਾ ਹੋਰ ਤਾਂ ਕੋਈ ਚੱਕਦਾ ਨਹੀਂ ਗਾ ਹਾਂ ਹਮ ਬਸ ਮਿੱਟੀ ਮੁੱਟੀ ਚੰਗੀ ਤਰ੍ਹਾਂ ਪਵਾ ਕੇ ਅਤੇ ਉਦੋਂ ਬਾਅਦ ਫਿਰ ਕੋਈ ਲਵਾ ਦਿੰਦੇ ਵਿੱਚ ਹੈ ਨਾ ਸੀਮਟ ਵਗੈਰਾ ਪਾ ਕੇ ਹਮ ਹਾਂ ਹਾਂ ਅਤੇ ਕਰਨਾ ਹੀ ਪੈਣਾ ਫਿਰ ਹੁਣ ਕਿਸੇ ਉਹਨਾਂ ਨੂੰ ਕਹਿੰਦੇ ਹਾਂ ਵੀ ਤੇਰੇ ਅੰਕਲ ਨੂੰ ਕਹਿੰਦੇ ਹਾਂ ਕਿਸੇ ਬੰਦੇ ਨੂੰ ਸੱਦ ਕੇ ਅਤੇ ਵੀ ਕਰਵਾ ਲੈਣ ਕੰਮ ਹਾਂ ਅਤੇ ਹੋਰ ਮੈਂ ਤਾਂ ਆਪ ਦੇਖਿਆ ਥੱਲੇ ਇੱਕ ਭਾਈ ਗੱਡੀ ਵਿੱਚ ਵੱਜੀ ਉਹਦੀ ਅਤੇ ਕਿੰਨਾ ਚਿਰ ਨਿਕਲੀ ਨਹੀਂ ਗੱਡੀ ਹਾਂ ਹਾਂ ਖੜ੍ਹਕਾ ਹੀ ਬਹੁਤ ਹੁੰਦਾ ਰੋਜ਼ ਇੱਕ ਦਾ ਇੱਕ ਤਾਂ ਆਪਣੀ ਗਲੀ 'ਚ ਅਤੇ ਇੱਕ ਉਹ ਆ ਸੜਕ 'ਤੇ ਆ ਟੋਆ ਜਿਹਾ ਉਹ ਤਾਂ ਰਾਤ ਨੂੰ ਜਦੋਂ ਗੱਡੀਆਂ ਲੰਘਦੀਆਂ ਇਹ ਲਗਦਾ ਜਿਵੇਂ ਕੋਈ ਐਕਸੀਡੈਂਟ ਹੋਇਆ ਠਾਅ ਦੇਣੀ ਵੱਜਦੀਆਂ ਵਿੱਚ ਇੱਕ ਦੂਜੇ ਦੇ ਅਤੇ ਨਾ ਕੋਈ ਸੜਕਾਂ ਅਤੇ ਨਾ ਕੋਈ ਸੜਕਾਂ ਕੋਈ ਕਰਦਾ ਨਾ ਗਲੀਆਂ ਕੋਈ ਕਰਦਾ ਹੈਗਾ ਅਤੇ ਆਪ ਨੂੰ ਇਹ ਹਿੰਮਤ ਕਰਨੀ ਪੈਣੀ ਆਪਾਂ ਸਾਰੇ ਪਾਸੇ ਕਰ ਹਾਂ ਹਾਂ ਹਾਂ ਠੀਕ ਆ ਚਲ ਠੀਕ ਹੈ ਫਿਰ ਹੈਂ ਆਪਾਂ ਗੱਲ ਕਰਕੇ ਉਹਨੂੰ ਕਰਦੇ ਹਾਂ ਠੀਕ ਚੱਲ ਓਕੇ ਠੀਕ ਹੈ ਓਕੇ ਹਾਂ